ਮੈਂ ਬਾਰਾਂ ਤੇਰਾਂ ਸਾਲ ਦੀ ਉਮਰ ਵਿੱਚ ਬੁਣਾਈ ਸ਼ੁਰੂ ਕਰ ਦਿੱਤੀ ਸੀ ਮੈਨੂੰ ਕਰੋਸ਼ੀਆ ਜ਼ਿਆਦਾ ਵਧੀਆ ਲੱਗਦਾ ਸੀ ਮੈਨੂੰ ਕਰੋਸ਼ੀਏ ਦੇ ਨਾਲ਼ ਹਰ ਚੀਜ਼ ਵੇਖ ਵੇਖ ਕੇ ਵੀ ਮੈਂ ਬਣਾ ਲੈਂਦੀ ਸੀ ਮੈਂ ਸਿੱਖੀ ਤੇ ਆਪਣੀ ਮੰਮੀ ਕੋਲੋਂ ਸਾ ਪਰ ਮੈਨੂੰ ਆ ਗਿਆ ਬੜੇ ਛੇਤੀ ਮੈਂ ਆਪਣੇ ਬੱਚਿਆਂ ਨੂੰ ਵੀ ਐ ਚੀਜ਼ ਆਪਣੀ ਬੇਟੀ ਨੂੰ ਬਹੁਤ ਵਧੀਆ ਤਰ੍ਹਾਂ ਵੀ ਮੇਰੇ ਕੋਲ਼ ਬਹਿ ਕੇ ਸਿੱਖ ਦੀ ਸੀ ਤੇ ਉਹਨੂੰ ਵੀ ਮੈਂ ਸਿਖਾਈ ਓਨੇ ਐਨੀ ਵਧੀਆ ਸਿੱਖ ਲਈ ਕੀ ਉਹ ਹੁਣ ਜੋ ਕੁਝ ਵੀ ਬਣਾਂਦੀ ਐ ਨਾ ਮੇਰੇ ਤੋਂ ਵੀ ਵਧੀਆ ਬਣਾਂਦੀ ਐ ਮੈਂ ਆਪਣੇ ਲੱਡੂ ਗੋਪਾਲ ਦੇ ਵੀ ਕੱਪੜੇ ਤੇ ਭਗਵਾਨ ਦੀਆਂ ਮੂਰਤੀਆਂ ਦੇ ਵੀ ਕੱਪੜੇ ਬੜੇ ਸੋਹਣੇ ਬਣਾ ਲੈਨੀ ਆਂ ਔਰ ਮੇਰੀ ਬੇਟੀ ਵੀ ਉਹਨੂੰ ਵੇਖ ਵੇਖ ਕੇ ਐਨੇ ਵਧੀਆ ਮੂਰਤੀਆਂ ਦੇ ਕੱਪੜੇ ਬਣਾਨ ਲੱਗ ਪਈ ਐ ਕੀ ਸਾਰੇ ਬਹੁਤ ਪਸੰਦ ਕਰਦੇ ਨੇ ਹੁਣ ਮੈਨੂੰ ਵੇਖ ਕੇ ਐਂਝ ਲੱਗਦਾ ਐ ਕੀ ਮੇਰੇ ਤੋਂ ਜ਼ਿਆਦਾ ਵਧੀਆ ਉਹ ਬਣਾਂਦੀ ਐ ਔਰ ਐਹ ਵੇਖ ਕੇ ਮੇਨੂੰ ਬੜਾ ਚੰਗਾ ਲੱਗਦਾ ਵੇ ਕੀ ਜੇ ਤੁਸੀਂ ਆਪ ਸਿੱਖੇ ਓ ਤੇ ਐਹ ਕੰਮ ਆਪਣੇ ਬੱਚਿਆਂ ਨੂੰ ਵੀ ਸਿਖਾਓ ਕੋਈ ਚੰਗੇ ਕੰਮ ਬੱਚੇ ਅੱਗੋਂ ਸਿੱਖਣ ਅੱਗੋਂ ਉਹ ਹੋਰ ਵੀ ਸਿੱਖਦੇ ਨੇ ਆਸੇ ਪਾਸੇ ਦੀਆਂ ਵੀ ਜਨਾਨੀਆਂ ਮੇਰਾ ਐਹ ਕੰਮ ਵੇਖ ਕੇ ਬੜੀਆਂ ਖੁਸ਼ ਹੁੰਦੀਆਂ ਨੇ ਤੇ ਆ ਕੇ ਮੇਰੇ ਕੋਲੋਂ ਐ ਚੀਜ਼ਾਂ ਸਿਖਦੀਆਂ ਨੇ ਤੇ ਮੈਨੂੰ ਬਹੁਤ ਚੰਗਾ ਲੱਗਦਾ ਵੇ ਐ ਸਾਰਾ ਕੁੱਝ ਤੇ ਹੁਣ ਹੁਣ ਮੈਂ ਇਜਾਜਤ ਚਾਨੀ ਆ ਧੰਨਵਾਦ ਜੀ